ਭਵਿੱਖ ਦੇ ਵਿੱਚ ਖੇਤੀ ਦੇ ਨਾਲ ਨਾਲ ਮੈਂ ਚਾਹਾਂਗਾ ਕਿ ਪੋਲਟਰੀ ਫਾਰਮ ਵੀ ਖੋਲ੍ਹਿਆ ਜਾਵੇ ਇਸ ਲਈ ਮੈਂ ਬਹੁਤ ਸਾਰੇ ਫਾਰਮ ਜਿਹੜੇ ਪੋਲਟਰੀ ਫਾਰਮ ਵਾਸਤੇ ਕੀ ਕੀ ਚੀਜ਼ਾਂ ਲੋੜੀਦੀਆਂ ਕਿੰਨੀ ਜਗ੍ਹਾ ਚਾਹੀਦੀ ਹੈ ਕੀ ਮਟੀਰੀਅਲ ਚਾਹੀਦਾ ਤਾਂ ਪ ਜਿਹੜੇ ਪੋਲਟਰੀ ਫਾਰਮ ਵਾਸਤੇ ਖੁਰਾਕ ਕੀ ਚਾਹੀਦੀ ਹੈ ਇਸ ਕਰਕੇ ਕਾਫੀ ਉਹਦੀ ਸਟੱਡੀ ਕਰ ਰਿਹਾ ਮੇਰੇ ਬਹੁਤ ਸਾਰੇ ਦੋਸਤਾਂ ਨੇ ਪੋਲਟਰੀ ਫਾਰਮ ਬਣਾਏ ਵੀ ਹੋਏ ਹੈ ਅਤੇ ਮੈਂ ਦੇਖਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਾਫ ਸੁਥਰੇ ਪੋਲਟਰੀ ਫਾਰਮ ਦਾ ਜਿਹੜਾ ਧੰਦਾ ਹੈ ਉਹ ਕਾਫੀ ਵਧੀਆ ਹੈ ਅਤੇ ਮੈਂ ਵੀ ਚਾਹਵਾਂਗਾ ਭਵਿੱਖ ਦੇ ਵਿੱਚ ਕਿ ਪੋਲਟਰੀ ਫਾਰਮ ਦਾ ਜਿਹੜਾ ਉਹ ਧੰਦਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਇਸ ਸ਼ਹਿਰ ਦੇ ਵਿੱਚ ਜਿਹੜੇ ਚੰਗੇ ਪੋਲਟਰੀ ਫਾਰਮ ਚੰਗੇ ਜਿਹੜਾ ਚਿਕਨ ਹੈ ਉਹ ਮਿਲ ਸਕੇ ਇਸ ਕਰਕੇ ਮੇਰਾ ਟੀਚਾ ਹੈ ਭਵਿੱਖ ਦੇ ਵਿੱਚ ਯ ਯੋਜਨਾ ਬਣਾ ਰਿਹਾ ਹਾਂ ਜਲਦੀ ਹੀ ਕੋਸ਼ਿਸ਼ ਕਰਾਂਗਾ ਕਿ ਭਵਿੱਖ ਦੇ ਵਿੱਚ ਹੋ ਸਕੇ ਤਾਂ ਇੱਕ ਜਿਹੜਾ ਪੋਲਟਰੀ ਫਾਰਮ ਖੁੱਲ੍ਹੇਗਾ